ਪੰਜਾਬੀ ਭਾਸ਼ਾ ਦੀ ਤੁਲਨਾ ਹਿੰਦੀ ਜਾਂ ਸੰਸਕ੍ਰਿਤ ਨਾਲ ਵੀ ਕੀਤੀ ਜਾ ਸਕਦੀ ਹੈਗੀ ਪੰਜਾਬੀ ਵਾਲੇ ਸ਼ਬਦ ਹੀ ਹਿੰਦੀ ਵਿੱਚ ਵੀ ਮਤਲਬ ਥੋੜ੍ਹਾ ਬਹੁਤ ਬੋਲਣ 'ਚ ਫਰਕ ਹੁੰਦਾ ਹੈਗਾ ਪਰ ਉਸ ਤਰ੍ਹਾਂ ਦੇ ਹੀ ਸ਼ਬਦ ਹੁੰਦੇ ਆ ਜਿਵੇਂ ਪਿਆਰ ਪਿਆਰ ਸ਼ਾਂਤੀ ਸ਼ਾਂਤੀ ਜੀਵਨ ਜੀਵਨ ਆਜ਼ਾਦੀ ਆਜ਼ਾਦੀ ਸਕੂਲ ਸਕੂਲ ਧੰਨੇਵਾਦ ਧੰਨਵਾਦ ਬਾਸ਼ਾ ਭਾਸ਼ਾ ਆਗ ਅੱਗ ਰਾਤ ਰਾਤ ਪਾਣੀ ਪਾਣੀ ਮਛਲੀ ਮੱਛੀ ਕਾਮ ਕੰਮ ਫੂਲ ਫੁੱਲ ਕੁੱਤਾ ਕੁੱਤਾ ਬਿੱਲੀ ਬਿੱਲੀ ਨਦੀ ਨਦੀ ਚਾਂਦ ਚੰਦ ਗੀਤ ਗੀਤ ਬੋਜਨ ਭੋਜਨ ਪਿਤਾ ਪਿਤਾ ਅਧਿਆਪਕ ਅਧਿਆਪਕ ਸਮੁੰਦਰ ਸਮੁੰਦਰ